ਮੈਨੂੰ ਵੈਸੇ ਤਾਂ ਸਟੈਂਪ ਅਤੇ ਸਿੱਕੇ ਇਕੱਠੇ ਕਰਨ ਦਾ ਬਹੁਤ ਹੀ ਜ਼ਿਆਦਾ ਸ਼ੌਂਕ ਹੈ ਬਟ ਜੇ ਮੈਂ ਅੱਜ ਦੀ ਗੱਲ ਕਰਾਂ ਤਾਂ ਮੇਰੇ ਕੁਝ ਕੋਲੇ ਕੁਝ ਡਬਲ ਪਏ ਹਨ ਜਿਹੜੇ ਕਿ ਮੈਂ ਬਹੁਤ ਹੀ ਸੰਭਾਲ ਕੇ ਰੱਖੇ ਹੋਏ ਹਨ ਇਹ ਮੇਰੇ ਲਈ ਬਹੁਤ ਹੀ ਖਾਸ ਹਨ ਕਿਉਂਕਿ ਇੱਕ ਤਾਂ ਇਹ ਮੇਰੇ ਵਿਰਸੇ ਦੇ ਨਾਲ ਰਿਲੇਟਡ ਹਨ ਅਤੇ ਦੂਜਾ ਇਹ ਮੈਨੂੰ ਮੇਰੇ ਬਚਪਨ ਦੀ ਯਾਦ ਦਿਵਾਉਂਦੇ ਹਨ ਕਿ ਕਿਵੇਂ ਅਸੀਂ ਬਚਪਨ ਦੇ ਵਿੱਚ ਇਹ ਛੋਟੇ ਛੋਟੇ ਸਿੱਕੇ ਜਿਹੜੇ ਆ ਉਹ ਸੰਭਾਲ ਸੰਭਾਲ ਕੇ ਰੱਖਦੇ ਸੀਗੇ ਅਤੇ ਇਹ ਮੈਨੂੰ ਬਹੁਤ ਹੀ ਜ਼ਿਆਦਾ ਪਿਆਰੇ ਹਨ ਅਤੇ ਮੈਨੂੰ ਲੱਗਦਾ ਹੈ ਕਿ ਇਹਨਾਂ ਨੂੰ ਸੰਭਾਲ ਕੇ ਰੱਖਣ ਦਾ ਇੱਕ ਮੇਰੇ ਕੋਲ ਮਿ ਮੁੱਖ ਉਦੇਸ਼ ਇਹ ਸੀ ਕਿ ਇਹਦੇ ਨਾਲ ਸਾਡੀ ਵਿਰਾਸਤ ਜੁੜੀ ਹੋਈ ਹੈ ਇਹ ਪੁਰਾਣੇ ਸਿੱਕੇ ਸ਼ਾਇਦ ਅੱਜ ਕੱਲ੍ਹ ਨਹੀਂ ਦੇਖਣ ਨੂੰ ਮਿਲਦੇ ਅਤੇ ਅਸੀਂ ਆਪਣੀ ਆਉਣ ਵਾਲੀ ਪੀੜੀ ਜਿਹੜੀ ਹਾਂ ਉਹਨਾਂ ਨੂੰ ਇਹ ਸਿੱਕੇ ਦਿਖਾ ਕੇ ਦੱਸ ਸਕਦੇ ਹਾਂ ਕਿ ਅਸੀਂ ਕਿੱਦਾਂ ਕਿਹੜੇ ਸਿੱਕੇ ਜਿਹੜੇ ਆ ਉਹ ਵਰਤਦੇ ਹੁੰਦੇ ਸੀ ਅਤੇ ਕਿੱਦਾਂ ਇਹਨਾਂ ਨੂੰ ਇਕੱਠੇ ਕਰਕੇ ਸਾਨੂੰ ਕਿੰਨੀ ਜ਼ਿਆਦਾ ਖੁਸ਼ੀ ਮਿਲਦੀ ਹੁੰਦੀ ਸੀ